ਹਾਂਜੀ ਨਮਸਕਾਰ ਜੀ ਹਾਂਜੀ ਉਹ ਜਿਹੜੇ ਉਹ ਗਲੀ ਤੇ ਜਿੰਮ ਦੇ ਸਾਹਮਣੇ ਹਾਂਜੀ ਹਾਂਜੀ ਆਇਆ ਸੀ ਜੀ ਹਾਂਜੀ ਹਾਂਜੀ ਨਹੀਂ ਹਾਂ ਇੱਕ ਤਾਂ ਨਾ ਤੁਸੀਂ ਚੈੱਕ ਕਰੇ ਨਹੀਂ ਸੀ ਗੱਲ ਨਾ ਘਰੇ ਤੁਸੀਂ ਐ ਨਹੀਂ ਸੀ ਮੇਰੇ ਖਿਆਲ 'ਚ ਨਹੀਂ ਨਹੀਂ ਮੇਰੇ ਪਤਾ ਕੀ ਮੇਰੀ ਗੱਲ ਸੁਣੋ ਸੋ ਰੁਪਏ ਨਾਲ ਅਸੀਂ ਪਹਿਲਾਂ ਦੇਖਿਆ ਟੂਟੀ ਜਿਹੜੀ ਸੀ ਪਲਸਟੀ ਦੀ ਸੀ ਉਹ ਠੀਕ ਹੈ ਜੀ ਤੇ ਜਦੋਂ ਮੈਂ ਠੀਕ ਹੈ ਜੀ ਤੇ ਜਦੋਂ ਮੈਂ ਆਇਆ ਨਾ ਤੇ ਤੁਹਾਡੀ ਜਿਹੜੀ ਫਿਟਿੰਗ ਵੇਖੀ ਨਾ ਮੈਂ ਉਦੋਂ ਵੇਖਿਆ ਕਿ ਲੱਗਣੀ ਨਹੀਂ ਇਥੇ ਤੁਹਾਡੀ ਮਮਾ ਨੂੰ ਕਿਹਾ ਵੀ ਸੀ ਸ਼ਾਇਦ ਮੈਂ ਪਤਾ ਨਹੀਂ ਮੈਂ ਭੁੱਲ ਗਿਆ ਪਤਾ ਗੱਡੀ ਮਮਾ ਭੁੱਲ ਗਿਆ ਮੈਂ ਕਿਹਾ ਵੀ ਸੀ ਮੈਂ ਆਂਟੀ ਜੀ ਇਹ ਨਾ ਪਲਾਸਟਿਕ ਦੀ ਟੂਟੀ ਹੈ ਪਲਸਟੀ ਵਾਲੀ ਫਿਟਿੰਗ ਹੈ ਪਲਸਟੀ ਵਾਲੀ ਫਿਟਿੰਗ ਨਹੀਂ ਹੈ ਮਤਲਬ ਵੀ ਇਹ ਦੇਖਣਾ ਸਟੀਲ ਵਾਲੀ ਟੂਟੀ ਲੱਗੇਗੀ ਉਹ ਜਿਹੜਾ ਰੇਟ ਆਪਾਂ ਸੋ ਰੁਪਏ ਗੱਲ ਕੀਤੀ ਸੀ ਨਾ ਉਹ ਪਲਸਟੀ ਵਾਲੀ ਦੀ ਕੀਤੀ ਸੀ ਠੀਕ ਹੈ ਜੀ ਤੇ ਜਦੋਂ ਮੈ ਆਇਆ ਨਾ ਤਾਂ ਤੁਹਾਡੀ ਗੱਲ ਸਹੀ ਹੈ ਪਰ ਫਿਰ ਪਤਾ ਕੀ ਮੈਂ ਸੋਚਿਆ ਮੈਂ ਕਿਹਾ ਚਲੋ ਲਿ ਮੈਂ ਕਰਨਾ ਮੈਂ ਤੁਹਾਡੀ ਮਮੀ ਤੋਂ ਕਿਹਾ ਵੀ ਸੀ ਮੈਂ ਕਹਿੰਦੀ ਜੀ ਫਿਰ ਕਰਦੀ ਹੈ ਮੈਂ ਕਹਿੰਦੀ ਵੇਖ ਲਓ ਵੇਖ ਲਓ ਤੇ ਮੈਂ ਲਿਆ ਮੈਂ ਜਾ ਕੇ

ਨਹੀਂ ਉਸ ਤੋਂ ਪਹਿਲਾਂ ਦੇਖੋ ਵੀ ਤੁਹਾਡੀ ਗੱਲ ਸਹੀ ਹੈ ਪਰ ਅਸੀਂ ਪਹਿਲਾਂ ਹੀ ਤੁਹਾਡੇ ਨਾਲ ਬੜੇ ਕਮ ਕੀਤੇ ਹੋਏ ਆ ਮਤਲਬ ਕਿ ਤਾਂ ਗੱਲ ਤੁਸੀਂ ਨਾ ਕਹੋਗੀ ਇਨੀ ਕੀਤੇ ਜਿਹੜੇ ਛੋਟੇ ਮੋਟੇ ਕੰਮ ਵਿੱਚ ਕੱਢੀ ਦਿੰਦੇ ਤੁਸੀਂ ਆਪ ਹਾਂ ਪੁਰਾਣਾ ਆ ਰਿਹਾ ਜੀ ਮੈਂ ਨਹੀਂ ਕੋਈ ਨਵੀਂ ਪਹਿਲੀ ਵਾਰ ਆਇਆ ਜੀ ਇਸੇ ਬਿਹਾਫ਼ ਤੇ ਨਾ ਮੇਰੀ ਗੱਲ ਸੁਣੋ ਮੈਂ ਸੋਚਿਆ ਮੈਂ ਕਿਹਾ ਚਲੋ ਕੀ ਯਾਰ ਫਿਰ ਮੈਂ ਕਿਹਾ ਵੀਰਾ ਮਿਸ਼ਨ ਮੈਗਾ ਵਧੀਆ ਕੰਮ ਵੀ ਕਰਾਉਂਦਾ ਹੁੰਦਾ ਮੈਂ ਕਿਹਾ ਮਾੜਾ ਤਾਂ ਕੰਮ ਕਦੀ ਕਰਾਇਆ ਨਹੀਂ ਵੇ ਨੀਂ ਮਾੜੀ ਮਾੜੀ ਚੀਜ਼ ਲਾ ਦਿੰਦਾ ਜਾ ਕੇ ਚਲ ਕੋਈ ਨਹੀਂ ਮੈਂ ਕਿਹਾ ਸੋ ਪੰਜਾਹ ਦੀ ਅੱਜ ਤਾਂ ਲੱਗੇ ਸੀ ਨਾਲੇ ਸਿਰਫ ਮਹੀਨੇ ਭਰ ਤਾਂ ਫਿਰ ਉਹੀ ਆ ਮੇਰੇ ਖਿਆਲ ਚ ਹਾਂਜੀ ਹਾਂਜੀ ਉਹ ਨਹੀਂ ਆਪਾਂ ਤਾਂ ਕੀ ਕਰਦੇ ਆ ਜੀ ਪੰਜਾਹ ਪਿੱਛੇ ਗੱਲ ਕੋਠੀ ਖੜੀ ਕਰ ਲਗੇ ਜੀ ਆਪਾਂ ਐਵੇਂ ਤਾਂ ਨਹੀਂ ਹੁੰਦਾ ਮਤਲਬ ਹਾਂਜੀ ਨਹੀਂ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਜਦੋਂ ਕੱਲ ਆਏ ਸੀ ਸਮਾਨ ਵੇਖੇ ਜਿਹੜਾ ਪਾਇਆ ਮੈਂ ਲੱਗਿਆ ਵੇਖਿਆ ਤੁਸੀਂ ਵਧੀਆ ਕੁਆਲਿਟੀ ਦਾ ਸਮਾਨ ਪਾਇਆ ਜੀ ਬਿਲਕੁਲ ਜਾਇਜ ਰੇਟ ਤੋਂ ਦੁਕਾਨ ਤੋਂ ਲੈ ਕੇ ਆਇਆ ਮੈਂ ਜਿੱਥੇ ਲੈ ਕੇ ਆਉਂਦੇ ਆਂ ਐਵੇਂ ਨਹੀਂ ਮੈਂ ਕਿਸੇ ਦਾ ਨਹੀਂ ਸੋਚਣ ਦਾ ਸੋਚਿਆ ਤੁਹਾਡਾ ਸੋਚਿਆ ਮੈਂ ਮੈਂ ਕਿਹਾ ਨਹੀਂ ਯਾਰ ਵਧੀਆ ਚੀਜ਼ ਪਾਣੀ ਤੇ ਜਾਇਜ ਰੇਟ ਲੈ ਕੇ ਜਾਣੀ ਹੈ ਕੱਲ ਕੱਲ ਟੂਟੀ ਲੱਗ ਗਈ ਲੀਕ ਵੀ ਕਰਨ ਲੱਗ ਗਈ ਉਹ ਨਹੀਂ ਜੀ ਭਾਜੀ ਐ ਨਹੀਂ ਕਹਿੰਦਾ ਜੀ ਚੈੱਕ ਕਰਾਇਆ ਮੈਂ ਤੁਹਾਡੀ ਮਮੀ ਨੂੰ ਮੈਂ ਤੁਹਾਡੀ ਮਮੀ ਚੈੱਕ ਕਰਾਇਆ ਜੀ ਵਧੀਆ ਤਰੀਕੇ ਨਾਲ ਮੈਂ ਵੇਖੋ ਐਟੀ ਵਧੀਆ ਚੱਲੀ ਜਾਂਦੀ ਲੀਕ ਦਾ ਜ਼ਿਕਰ ਨਹੀਂ ਤਾਂ ਨਹੀਂ ਚਾਹੀਦੀ ਚਲੋ ਜੀ ਮੈਂ ਕਰਾਂਗਾ ਜੀ ਚਲੋ ਗੱਲ ਆਪਾਂ ਐ ਕਰਦੇ ਆ ਗੱਲ ਮੁ ਕਰਦੇ ਆ ਆਪਾਂ ਤੇ ਮੈਂ ਕਰਾਂਗਾ ਤੁਹਾਡੇ ਨਾਲ ਲੀਕ ਕਰ ਰਹੀ ਹਨੂੰ ਟਾਈਮ ਨਹੀਂ ਉਹ ਸ਼ਾਮ ਤੱਕ ਕਰਦਾ ਮੈਂ ਦੇਖ ਕੇ ਜਾਂਦਾ ਨਾ ਤੇ ਤੁਸੀਂ ਡੇਢ ਸੋ ਕਿਹਾ ਪਹਿਲਾ ਤੁਸੀਂ ਐ ਕਰੋ ਤੁਸੀਂ ਦੇਖ ਸ ਮੈਨੂੰ ਤੁਸੀਂ ਮੈਂ ਡੇਢ ਸੈਂਡ ਕਰਦੋ ਹਾਂ ਨੀ ਮੈਂ ਮੈਂ ਆਵਾਂਗਾ ਮੈਂ ਸ਼ਾਮ ਤੱਕ ਸਵੇਰ ਤੈਨੂੰ ਕੋਈ ਟਾਈਮ ਨਹੀਂ ਹੈ ਨਹੀਂ ਨਹੀਂ ਉਹ ਤਾਂ ਕੋਈ ਤੁਸੀਂ ਭਰਾ ਨਹੀਂ ਹੈਗੇ ਉਹ ਤਾਂ ਹੀ ਮੈਂ ਤੁਹਾਡੇ ਕੋਲੋਂ ਮੈਂ ਸਿੱਧਾ ਹੀ ਜਾ ਕੇ ਲਿਆ ਸਮਾਨ ਨਾ ਗਿਆ ਚਲੋ ਕੋਈ ਨਹੀਂ ਵੀਰਾਂ ਦਾ ਵਧੀਆ ਕਲੱਬ ਹੁੰਦਾ ਆਪਾਂ ਨੂੰ ਕੀ ਚੱਕਰ ਕੋਈ ਨੀ ਮੈਂ ਆਦਾ ਸ਼ਾਮੀ ਮੈਂ ਸ਼ਾਮੇ ਆ ਕੇ ਵੇਖ ਜਾਂਗਾ ਜੀ ਤੇ ਇਸ ਤੋਂ ਬਾਅਦ ਜਿੰਨੇ ਵੀ ਪੈਸੇ ਤੁਸੀਂ ਡੇਢ ਹੋ ਗਿਆ ਡੇਢ ਦੇ ਹਾਂ ਉਹ ਤਾਂ ਉਹੀ ਵੇਖਣਾ ਵਾ ਮੇਨ ਤਾਂ ਮੈਂ ਨਹੀਂ ਨਹੀਂ ਉਹ ਤਾਂ ਕਦੇ ਨਾ ਕੀਤੀ ਨਹੀਂ ਜੀ ਹੋਰ ਆਪਾਂ ਕਦੇ ਨਾ ਕੀਤੀ ਨਹੀਂ ਨਹੀਂ ਹਾਂ ਵੀ ਕਰਦੇ ਆ ਜੀ ਨਾ ਉਹ ਵੀ ਨਹੀਂ ਕਰਦੇ ਨਾ ਵੀ ਕਰਦੇ ਨਾ ਵੀ ਨਹੀਂ ਕਰਦੇ ਨਹੀਂ ਨਹੀਂ ਕੋਈ ਨਹੀਂ ਜੀ ਆਪਾਂ ਅੱਜ ਸ਼ਾਮੀ ਆ ਗਏ ਸਾਰੇ ਤੁਹਾਡੇ ਜਿਹੜੇ ਵੀ ਹੈਗੇ ਆ ਦੂਰ ਕਰ ਦਾਂਗੇ ਕਸ਼ਟ ਜਿਹੜੇ ਹੈਗੇ ਆ ਆਸ਼ਾਮੀ ਆਸ਼ਾਮੀ ਆ ਜਾ ਠੀਕ ਹੈ ਜੀ ਠੀਕ ਹੈਜੀ ਠੀਕ ਹੈ ਜੀ